ਮੈਂ ਮੰਨਦੀ ਹਾਂ ਕਿ ਪ੍ਰੈਸ ਦੀ ਆਜ਼ਾਦੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਲੋਕਾਂ ਤੱਕ ਸੱਚ ਪਹੁੰਚਾਉਣ ਦਾ ਸਭ ਤੋਂ ਵੱਡਾ ਸਰੋਤ ਹੈ ਪਰ ਆਜ਼ਾਦੀ ਨਾਲ ਜ਼ਿੰਮੇਵਾਰੀ ਵੀ ਆਉਂਦੀ ਹੈ ਅੱਜ ਕੱਲ੍ਹ ਹਰ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ ਕੁਝ ਸੱਚ ਹੁੰਦੀਆਂ ਹਨ ਪਰ ਬਹੁਤੀਆਂ ਤੋੜ ਮਰੋੜ ਕੇ ਅਧੂਰੀ ਜਾਂ ਕਿਸੇ ਨਿੱਜੀ ਫਾਇਦੇ ਲਈ ਪੇਸ਼ ਕੀਤੀਆਂ ਜਾਂਦੀਆਂ ਹਨ ਮੈਂ ਹਰ ਖ਼ਬਰ 'ਤੇ ਤੁਰੰਤ ਵਿਸ਼ਵਾਸ ਨਹੀਂ ਕਰਦੀ ਪਹਿਲਾਂ ਇਸ ਦੀ ਜਾਂਚ ਕਰਦੀ ਹਾਂ ਤਾਂ ਜੋ ਪਤਾ ਲੱਗ ਸਕੇ ਕਿ ਕੀ ਕੁਝ ਸੱਚਮੁੱਚ ਹੋਇਆ ਹੈ ਅਤੇ ਕੀ ਇਹ ਬਣਾਵਟੀ ਹੈ ਅੱਜ ਕੱਲ ਸ਼ੋਸ਼ਲ ਮੀਡੀਆ 'ਤੇ ਨਕਲੀ ਖ਼ਬਰਾਂ ਵੀ ਵੱਧ ਰਹੀਆਂ ਹਨ ਇਸ ਕਰਕੇ ਸਮਝਦਾਰੀ ਨਾਲ ਖ਼ਬਰਾਂ ਨੂੰ ਵੇਖਣ ਦੀ ਲੋੜ ਹੈ ਸੱਚੀ ਪੱਤਰਕਾਰਤਾ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ ਪਰ ਉਨਾਂ ਨੂੰ ਵੀ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਤਾਂ ਜੋ ਲੋਕਾਂ ਤੱਕ ਸਿਰਫ ਸੱਚ ਪਹੁੰਚੇ ਨਾ ਕਿ ਕੋਈ ਝੂਠੀ ਜਾਣਕਾਰੀ ਧੰਨਵਾਦ